ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਸ਼ਹਿਰੀ ਲੋਕਾਂ ਤੋਂ ਜ਼ਿਆਦਾ ਪੇਂਡੂ ਲੋਕਾਂ ਨੂੰ ਜੋ ਹੈ ਚੁਣੌਤੀਆਂ ਸਾਹਮਣਾ ਕਰਨਾ ਪੈਂਦਾ ਹੈ ਪੇਂਡੂ ਲੋਕ ਅਗਰ ਪੜ੍ਹੇ ਲਿਖੇ ਹੋਣ ਤਾਂ ਇਹ ਥੋੜ੍ਹੀ ਆਸਾਨੀ ਹੁੰਦੀ ਹੈ ਲੇਕਿਨ ਜੇ ਉਹ ਘੱਟ ਪੜ੍ਹੇ ਲਿਖੇ ਹਨ ਤਾਂ ਚੁਣੌਤੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਪੇਂਡੂ ਲੋਕਾਂ ਨੂੰ ਚੁਣੌਤੀਆਂ ਜਿਵੇਂ ਕਿ ਪੈਸੇ ਦੀ ਕਿੱਲਤ ਸਭ ਤੋਂ ਪਹਿਲਾਂ ਹੀ ਹੁੰਦੀ ਹੈ ਦੂਸਰਾ ਪੇਂਡੂ ਲੋਕਾਂ ਨੂੰ ਅਗਰ ਉਨ੍ਹਾਂ ਦੇ ਕੋਂਟੈਕਟ ਵਿੱਚ ਲੋਕ ਘੱਟ ਨੇ ਅਤੇ ਉਨ੍ਹਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਨਵੇਂ ਨਵੇਂ ਆਈਡਿਆ ਮਿਲਣ 'ਚ ਵੀ ਮੁਸ਼ਕਲ ਹੋ ਸਕਦੀ ਹੈ ਅਤੇ ਇਹ ਜਿਹੜੇ ਆਈਡੀਏ ਨੇ ਅਗਰ ਆਈਡੀਏ ਨਹੀਂ ਮਿਲਦੇ ਤਾਂ ਉਹ ਨਵੇਂ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨ ਦੇ ਵਿੱਚ ਅ ਅਗਰ ਸ਼ੁਰੂ ਕਰਦੇ ਵੀ ਨੇ ਅਤੇ ਉਨ੍ਹਾਂ ਨੂੰ ਕਾਰੋਬਾਰ 'ਚ ਵਾਧਾ ਜਲਦੀ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਦੇ ਲਈ ਇੱਕ ਪੂਰੀ ਜੋ ਹੈਗੀ ਹੈ ਅ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਪੇਂਡੂ ਲੋਕਾਂ ਨੂੰ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ ਪੇਂਡੂ ਭਾਰਤ ਦੇ ਕਾਰੋਬਾਰਾਂ ਨੂੰ ਸਮਰਥਨ ਦੇਣ ਲਈ ਅ ਬਹੁਤ ਤਰੀਕੇ ਦੇ ਜੋ ਹੈ ਕੰਮ ਕੀਤੇ ਜਾਂਦੇ ਜਿਵੇਂ ਕਿ ਪੇਂਡੂ ਔਰਤਾਂ ਨੂੰ ਕੁਛ ਇੱਦਾਂ ਦੇ ਕੰਮ ਸਿਖਾਏ ਜਾ ਸਕਦੇ ਨੇ ਜੋ ਸ਼ਹਿਰ 'ਚ ਆ ਕੇ ਵੀ ਕੰਮ ਸ਼ੁਰੂ ਹੋ ਸਕਦਾ ਹੈ ਜਿਵੇਂ ਸਿਲਾਈ ਦਾ ਕਢਾਈ ਦਾ ਜਾਂ ਫਿਰ ਖਾਦ ਦਾ ਕੰਮ ਜਾਂ ਕਿਚਨ ਗਾਰਡਨ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੋ ਰਿਹਾ ਹੈ ਕਿਚਨ ਗਾਰਡਨ ਦਾ ਕੰਮ ਪਿੰਡ ਪਿੰਡ ਦੀ ਜਿਹੜੀ ਔਰਤਾਂ ਨੇ ਉਹ ਖੇਤੀਬਾੜੀ ਕਰਨ 'ਚ ਓਦਾਂ ਵੀ ਬੜੀ ਅਵਲ ਹੁੰਦੀਆਂ ਨੇ ਅਗਰ ਉਨ੍ਹਾਂ ਨੂੰ ਕਿਚਨ ਗਾਰਡਨ ਯਾਨੀ ਕਿ ਸ਼ਹਿਰ ਦੇ ਲੋਕਾਂ ਦ ਦੇ ਵਸੇਰੇ 'ਤੇ ਆ ਕੇ ਉਨ੍ਹਾਂ ਨੂੰ ਕਿਚਨ ਗਾਰਡਨ ਦੀ ਪ੍ਰੇਰਨਾ ਦੇਣ ਦੇ ਲਏ ਦੇ ਕੰਮ ਕਾਰੋਬਾਰ ਖੋਲ੍ਹਣ ਦੇ ਲਈ ਸਮਰਥਨ ਦਿੱਤਾ ਜਾਵੇ ਅਤੇ ਉਨ ਦੇ 'ਚ ਫਾਇਦਾ ਹੋਵੇਗਾ ਸਰਕਾਰ ਨੂੰ ਵੀ ਅਤੇ ਪਿੰਡ ਦੇ ਲੋਕਾਂ ਨੂੰ ਵੀ ਇਹ ਕਾਰੋਬਾਰ ਜੋ ਹੈ ਆਉਣ ਵਾਲੇ ਟੈਮ ਦੇ ਵਿੱਚ ਵੱਧੇਗਾ ਵੀ ਤਾਂ ਕਿਉਂਕਿ ਅੱਜ ਕੱਲ੍ਹ ਲੋਕ ਹੈਲਥ ਨੂੰ ਲੈ ਕੇ ਜ਼ਿਆਦਾ ਜਗਰੁਕ ਹੋ ਰਹੇ ਨੇ ਅਤੇ ਹੈਲਥ ਦੇ ਲਈ ਓਰਗੈਨਿਕ ਚੀਜ਼ਾਂ ਜੋ ਹੈ ਉਨ੍ਹਾਂ ਦੀ ਵੀ ਜੋ ਡਿਮਾਂਡ ਹੈਗੀ ਆ ਉਹ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਅਗਰ ਪਿੰਡ ਦੇ ਅ ਲੋਕ ਅ ਇਹ ਕੰਮ ਸ਼ੁਰੂ ਕਰਦੇ ਓਰਗੈਨਿਕ ਖੇਤੀ ਕਰਕੇ ਸ਼ਹਿਰਾਂ ਦੇ ਵਿੱਚ ਵਰਕ ਸ਼ੋਪ ਵਗੈਰਾ ਲਗਾਉਂਦੇ ਨੇ ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਜੋ ਹੈ ਫਾਇਦਾ ਮਿਲੇਗਾ ਔਰ ਇਹ ਕਾਰੋਬਾਰ ਚੱਲੇਗਾ ਵੀ ਅਤੇ ਉਸ ਤੋਂ ਬਾਅਦ ਨਵੇਂ ਨਵੇਂ ਆਈਡਿਆ ਹੋਰ ਆਉਣਗੇ ਜਿਵੇਂ ਕਿ ਓਰਗੈਨਿਕ ਫ਼ੂਡ ਵਾਲਾ ਰੈਸਟੋਰੈਂਟ ਖੋਲ੍ਹਣਾ ਐਨ ਦੇ ਵਿੱਚ ਵੀ ਸਮਰਥ ਦਿੱਤਾ ਜਾ ਸਕਦਾ ਹੈ ਤਾਂ ਕਿ ਉਹ ਖੁਦ ਉਗਾ ਕੇ ਉਗਿਆ ਹੋਇਆ ਆਉਣੇ ਹੱਥੀਂ ਉਗਿਆ ਹੋਇਆ ਹੀ ਆਪਣੇ ਰੈਸਟੋਰੈਂਟ 'ਚ ਵੇਚ ਸਕਣ ਐਨ ਦੇ ਨਾਲ ਸਿਰਫ਼ ਪੇਂਡੂ ਲੋਕਾਂ ਨੂੰ ਸਮਰਥਨ ਨਹੀਂ ਮਿਲੇਗਾ ਬਲਕਿ ਭਾਰਤ ਦੇ ਲੋਕਾਂ ਨੂੰ ਭਾਰਤ ਨੂੰ ਬਹੁਤ ਪਰ ਸਮਰਥਨ ਮਿਲੇਗਾ ਅਤੇ ਇੱਕ ਹੈਲਦੀ ਜੀਵਨ ਜੀਣ ਦੀ ਜੋ ਹੈ ਕਾਫ਼ੀ ਜੋ ਹੈ ਅੱਗੇ ਆਉਣ ਵਾਲੇ ਟੈਮ ਦੇ ਵਿੱਚ ਲੋਕਾਂ ਨੂੰ ਪ੍ਰੇਰਨਾ ਮਿਲੇਗੀ